ਮੇਰੀ ਸਭ ਤੋਂ ਸੁੰਦਰ ਯਾਤਰਾ ਇਹ ਹੈ ਕਿ ਮੈਂ ਆਪਣੇ ਘਰਦਿਆਂ ਨਾਲ ਜਦੋਂ ਮਨਾਲੀ ਗਿਆ ਸੀ ਛੋਟੇ ਹੁੰਦੇ ਤਾਂ ਉਹਨਾਂ ਨੇ ਮੈਨੂੰ ਜਦੋਂ ਆਪਾਂ ਮਨਾਲੀ ਗਏ ਆਪਾਂ ਬੱਸਾਂ ਵਿੱਚ ਗਏ ਆਪਾਂ ਅਤੇ ਆਪਾਂ ਉਹਨਾਂ ਨੇ ਆਪਾਂ ਇੱਕ ਟਰੈਵਲਰ ਬੁੱਕ ਕੀਤੀ ਸੀ ਜੋ ਕਿ ਸਾਨੂੰ ਮਿਰਾਜ ਤੱਕ ਛੱਡ ਸਕੇ ਅਤੇ ਆਪਾਂ ਉੱਥੇ ਬਹੁਤ ਸਾਰਾ ਨਜ਼ਾਰੇ ਲਿੱਤੇ ਅਤੇ ਆਪਾਂ ਕਈ ਹੋਟਲਾਂ ਵਿੱਚ ਵੀ ਰੁਕੇ ਆਪਾਂ ਫਿਰ ਹੋਟਲਾਂ ਵਿੱਚ ਰੁਕ ਕੇ ਆਪਾਂ ਖਾੜਾ ਖਾਧਾ ਪੀਤਾ ਆਪਾਂ ਬਹੁਤ ਵਧੀਆ ਨਜ਼ਾਰੇ ਕੀਤੇ ਫਿਰ ਆਪਾਂ ਘਰਦਿਆਂ ਨਾਲ ਫਿਰ ਆਪਾਂ ਬਾਅਦ ਟਰੈਵਲ ਬੁੱਕ ਨੂੰ ਕਰਕੇ ਫਿਰ ਆਪਾਂ ਬਾਹਰ ਘੁੰਮਣ ਚਲੇ ਗਏ ਬਾਹਰ ਘੁੰਮ ਕੇ ਆਪਾਂ ਬਹੁਤ ਸਾਰੇ ਨਜ਼ਾਰੇ ਕੀਤੇ ਫਿਰ ਇਸ ਤੋਂ ਬਾਅਦ ਆਪਾਂ ਬਾਹਰ ਦੀਆਂ ਚੀਜ਼ਾਂ ਖਾਧੀਆਂ ਜਿਵੇਂ ਕਿ ਪੀਜ਼ਾ ਮੋਮੋਜ ਸਭ ਕੁਛ ਖਾਧਾ ਫਿਰ ਆਪਾਂ ਉੱਥੋਂ ਦੇ ਮੰਦਰ ਘੁੰਮੇ ਮੰਦਰ 'ਚ ਕੀ ਕੀ ਹੈ ਬੁੱਧ ਦਾ ਮੰਦਰ ਘੁੰਮਿਆ ਸਭ ਕੁਛ ਅ ਵੇਖਿਆ ਅਤੇ ਫਿਰ ਆਪਾਂ ਉੱਥੋਂ ਦੇ ਆਪਾਂ ਉੱਥੇ ਫਿਰ ਨਜ਼ਾਰੇ ਕੀਤੇ ਕਿ ਆਪਾਂ ਉੱਥੇ ਬਰਫਾਂ ਨਾਲ ਬਰਫ ਦੇ ਨਾਲ ਵੀ ਖੇਡੇ ਸੀ ਅਤੇ ਆਪਾਂ ਉੱਥੇ ਸਕੀਨ ਵੀ ਕੀਤੀ ਸੀ ਸਭ ਕੁਛ ਕੀਤਾ ਆਪਣੇ ਘਰਦਿਆਂ ਨਾਲ ਫਿਰ ਆਪ ਉੱਥੇ ਫੋਟੋਆਂ ਖਿੱਚੀਆਂ ਸਭ ਕੁਛ ਕੀਤਾ ਅਤੇ ਫਿਰ ਆਪਾਂ ਉੱਥੇ ਦੇ ਮੰਦਰ ਘੁੰਮੇ ਜਿਹੜਾ ਕਿ ਸਭ ਤੋਂ ਫੇ ਫੇਮਸ ਹੈਗਾ ਸੀ ਬੁੱਧ ਦਾ ਆਪਾਂ ਉੱਥੇ ਬੁੱਧ ਦੇ ਮੰਦਰ ਘੁੰਮੇ ਆਪਾਂ ਉਹਨਾਂ ਦਾ ਇਤਿਹਾਸ ਜਾਣਿਆ ਕੀ ਕੀ ਹੁੰਦਾ ਹੈ ਕਿਵੇਂ ਹੈ ਉਹ ਏ ਕਿੱਥੋਂ ਦੇ ਕਿੱਥੋਂ ਦੇ ਰਹਿਣ ਵਾਲੇ ਸਨ ਉਹ ਬੁੱਧ ਅਤੇ ਉੱਥੇ ਸਭ ਕੁਛ ਕੀਤਾ ਫਿਰ ਆਪਾਂ ਚਾਰ ਪੰਜ ਦਿਨ ਬਾਅਦ ਆਪਾਂ ਘਰ ਵਾਪਸ ਆ ਗਏ ਫਿਰ ਇਸ ਤੋਂ ਬਾਅਦ ਸਭ ਕੁਛ ਕੀਤਾ ਅਤੇ ਫਿਰ ਆਪਾਂ ਨਾ ਘਰਦਿਆਂ ਘਰ ਜਾ ਕੇ ਮੈਂ ਆਪਣੇ ਦੋਸਤਾਂ ਨਾਲ ਇਹ ਗੱਲਬਾਤ ਸ਼ੇਅਰ ਕੀਤੀ ਕਿ ਮੈਂ ਇੱਥੇ ਜਾ ਕੇ ਘੁੰਮਿਆ ਫਿਰ ਮੈਂ ਉੱਥੋਂ ਦਾ ਇ ਇਹ ਵੀ ਦੇਖਿਆ ਕਿ ਆਪਾਂ ਸੂਰਜ ਕਿਵੇਂ ਡੁੱਬਦਾ ਹੈ ਅਤੇ ਕਿਵੇਂ ਚੜਦਾ ਹੈ ਮੈਨੂੰ ਉਹ ਬਹੁਤ ਨਜ਼ਾਰਾ ਵਧੀਆ ਲੱਗਾ ਕਿ ਜਦੋਂ ਸਨਸੈੱਟ ਉੱਗਿਆ ਅਤੇ ਜਦੋਂ ਸਨਸੈੱਟ ਡੁੱਬਿਆ ਬਹੁਤ ਵਧੀਆ ਫੀਲਿੰਗ ਵਾਲਾ ਨਜ਼ਾਰਾ ਸੀ ਥੈਂਕ ਯੂ